ਸਤਿ ਸ਼੍ਰੀ ਅਕਾਲ ਭੈਣ ਸ਼ੀਤਲ ਬੜੇ ਦਿਨਾਂ ਬਾਅਦ ਨਜ਼ਰ ਆਈ ਹੈ ਕਿੱਥੇ ਸੀ ਤੂੰ ਭਲਾ ਅੱਛਾ ਤੂੰ ਵਿਆਹ ਦੀ ਪੱਚੀਵੀਂ ਸਾਲ ਗਿਰਾਹ ਦੀ ਪਾਰਟੀ ਵਿੱਚ ਰੁਝੇੀ ਹੋਈ ਸੀ ਅੱਛਾ ਫਿਰ ਪਾਰਟੀ ਦਾ ਪ੍ਰਬੰਧ ਤੂੰ ਕਿੱਥੇ ਕੀਤਾ ਅੱਛਾ ਅੱਛਾ ਟੇਸਟੀ ਫੋਡ ਰੈਸਟੋਰੈਂਟ 'ਤੇ ਅੱਛਾ ਕਿਵੇਂ ਆ ਉਹਨਾਂ ਦਾ ਪ੍ਰਬੰਧ ਖਾਣਾ ਸਰਵਿਸ ਸਮਾਨ ਸੁਆਦ ਸੀ ਅਤੇ ਉਹਨਾਂ ਦੇ ਰੇਟ ਕਿਸ ਤਰ੍ਹਾਂ ਸੀਗੇ ਗ੍ਰਾਹਕਾਂ ਦਾ ਕਾਫ਼ੀ ਰਸ਼ ਹੋਣਾ ਉੱਥੇ ਮੈਨੂੰ ਲੱਗਦਾ ਤੁਸੀਂ ਉੱਥੇ ਪ੍ਰਬੰਧ ਕੀਤਾ ਆ ਉੱਥੇ ਦਾ ਸਟਾਫ ਕਿਸ ਤਰ੍ਹਾਂ ਦਾ ਸੀ ਖਾਣੇ ਦਾ ਸੁਆਦ ਕੁਆਲਿਟੀ ਕਿਵੇਂ ਦੀ ਸੀ ਅੱਛਾ ਤੁਹਾਡੇ ਪਰਿਵਾਰ ਵਾਲਿਆਂ ਨੂੰ ਉੱਥੋਂ ਦਾ ਖਾਣਾ ਬਹੁਤ ਪਸੰਦ ਆਇਆ ਵਾਹ ਜੀ ਵਾਹ ਫਿਰ ਤਾਂ ਤੁਹਾਡੀ ਪਾਰਟੀ ਵਿੱਚ ਸਾਰਿਆਂ ਨੇ ਭੋਜਨ ਦਾ ਆਨੰਦ ਮਾਣਿਆ ਹੋਵੇਗਾ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦਾ ਖਾਣਾ ਵੀ ਸੁਆਦ ਸੀ ਅਤੇ ਰੇਟ ਵੀ ਵਾਜਿਬ ਸੀ ਅੱਛਾ ਮਤਲਬ ਮੈਂ ਵੀ ਆਪਣੇ ਪ੍ਰੋਗਰਾਮ ਲਈ ਉੱਥੋਂ ਖਾਣਾ ਆਡਰ ਕਰ ਸਕਦੀ ਹਾਂ ਤੇਰੀ ਕੀ ਸਲਾਹ ਆ ਕੀ ਇਹ ਮੈਨੂੰ ਠੀਕ ਰਹੇਗਾ ਠੀਕ ਹੈ ਭੈਣ ਠੀਕ ਹੈ ਮੈਂ ਹੁਣੇ ਹੀ ਫੋਨ ਕਰਕੇ ਉੱਥੇ ਬੁਕਿੰਗ ਕਰਦੀ ਹਾਂ